ਹੈਲੋ ਹਾਂਜੀ ਬਾਈ ਜੀ ਕੌਣ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂ ਬਸ ਇੱਕ ਤੁਹਾਡੇ ਆਹ ਕੱਲ੍ਹ ਹੀ ਵਿਆਹ ਸੀਗਾ ਇੱਥੇ ਐਤਵਾਰ ਅਤੇ ਉਹ ਆਪਣੇ ਗੁਰਬਚਨ ਸਿੰਘ ਜੇ ਈ ਸਾਹਿਬ ਆ ਗਏ ਉਹਨਾਂ ਦੇ ਰੇਲੀਟਿਵ ਸੀਗੇ ਉਹ ਜੇ ਈ ਸਾਹਿਬ ਨੇ ਸਾਰੇ ਇੱਥੋਂ ਹੀ ਮੇਰੀ ਦੁਕਾਨ ਤੋਂ ਹੀ ਸਲੈਕਸ਼ਨ ਉਹਨਾਂ ਨੂੰ ਦਿਵਾਈ ਹੈਗੀ ਹਾਂ ਸਾਰੇ ਵਿਆਹ ਸ਼ਾਦੀ ਦੇ ਬੂਟ ਉਹਨਾਂ ਦੇ ਕਾਫੀ ਲੈ ਕੇ ਗਏ ਆ ਉਹ ਆਪਣੇ ਕੋਲੋਂ ਦਸ ਬਾਰ੍ਹਾਂ ਹਜ਼ਾਰ ਦਾ ਮਾਲ ਲੈ ਕੇ ਗਏ ਆ ਜੀ ਹੂੰ ਹੂੰ ਹੂੰ ਹਾਂਜੀ ਅੱਛਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਲੇਡੀਜ ਘਰ ਘਰੇਲੂ ਲੇਡੀਜ ਵਾਸਤੇ ਵੀ ਹੈਗਾ ਮ ਮਾਤਾ ਹੁੰਦੀਆਂ ਜਿਹੜੀ ਉਹਨਾਂ ਵਾਸਤੇ ਵੀ ਹੈਗਾ ਜਿਹੜੀਆਂ ਕੰਮ ਕਰਨ ਜਾਣੀ ਦਫਤਰ ਵਾਲੀਆਂ ਲੇਡੀਜ਼ ਹਰ ਪ੍ਰਕਾਰ ਦੇ ਹੈਗੇ ਬਾਈ ਜੀ ਆਪਣੇ ਕੋਲ ਹਾਂਜੀ ਹਾਂਜੀ ਤੁਸੀਂ ਲੇਡੀਜ਼ ਦੇ ਪੁੱਛਦੇ ਹੋ ਕਿ ਜੈਂਟਸ ਦੇ ਜੀ ਹਾਂ ਜੈਂਟਸ ਆਪਣੇ ਕੋਲ ਜ਼ਿਆਦਾਤਰ ਲਿਬਰਟੀ ਹੁੰਦੇ ਆ ਜੀ ਹਾਂ ਐਡੀਡਾਸ ਦੇ ਵੀ ਰੱਖਦੇ ਹਾਂ ਜੀ ਆਪਾਂ ਲਿਬਰਟੀ ਹੋ ਗਿਆ ਐਡੀਡਾਸ ਹੋ ਗਿਆ ਰੀਬੋਕ ਹੋ ਗਿਆ ਰੈਡ ਟੇਪ ਹੋ ਗਿਆ ਹਾਂਜੀ ਹਾਂਜੀ ਹਾਂ ਕੱਲ੍ਹ ਆਏ ਸੀ ਹਾਂ ਕਾਹਦੇ ਜੀ ਹਾਂ ਕੈਂਪਸ ਦੇ ਵੀ ਹੈਗੇ ਆ ਜੀ ਕਿਉਂਕਿ ਇਹ ਲੋਕਲ ਬਰਾਂਡ ਹੈ ਇਹ ਹੈਗੇ ਆ ਆਪਣੇ ਕੋਲ ਸਾਰੇ ਹੀ ਹੈ ਜੀ ਹਾਂਜੀ ਹਾਂਜੀ ਬੱਚਿਆਂ ਵਾਲੇ ਵੀ ਬਹੁਤ ਵਧੀਆ ਕੁਲੈਕਸ਼ਨ ਆ ਜੀ ਆਪਣੇ ਕੋਲ ਲਾਇਟਾਂ ਵਾਲੇ ਚਿਸ਼ਤੀਆਂ ਵਾਲੇ ਕਿਹੋ ਜਿਹੇ ਮਰਜ਼ੀ ਲਓ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਫੌਰਮਲ ਬਹੁਤ ਵਧੀਆ ਕਲੈਕਸ਼ਨ ਆਈ ਹੈ ਆਪਣੇ ਕੋਲ ਨਵੀਂ ਵੇਖੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਬੈਲੀ ਤੁਸੀਂ ਕੁੜਤੇ ਪਜਾਮੇ ਨਾਲ ਪਾਉਣ ਵਾਲੀ ਲੈ ਨਾਲ ਵੀ ਤੁਹਾਡੇ ਵਧੀਆ ਸੁਟੇਬਲ ਹੋਊਗੀ ਜੀਨਸ ਦੇ ਨਾਲ ਵੀ ਬ ਬਹੁਤ ਵਧੀਆ ਬੈਲੀਸ ਵੀ ਨੇ ਆਪਣੇ ਕੋਲ ਹਾਂ ਹਾਂ ਹਾਂਜੀ ਜੀ ਹਾਂ ਵੀਰੇ ਹਰ ਇੱਕ ਪ੍ਰਕਾਰ ਦੇ ਹੈਗੇ ਕਿਹੋ ਜਿਹੇ ਮਰਜ਼ੀ ਲੈ ਕੇ ਆਓ ਲਉ ਤੁਸੀਂ ਨਿਰਾਸ਼ ਹੋ ਕੇ ਨਹੀਂ ਜਾਊਗੇ ਪੂਰੇ ਖੁਸ਼ ਹੋ ਕੇ ਜਾਊਗੇ ਇੰਨੀ ਵਧੀਆ ਕੁਲੈਕਸ਼ਨ ਆ ਆਪਣੇ ਕੋਲ ਬਾਈ

ਹਾਂਜੀ ਹਾਂਜੀ ਬਾਈ ਜੀ ਗਰੰਟੀ ਫੁੱਲ ਗਰੰਟੀ ਦੇਵਾਂਗੇ ਪੱਕਾ ਤੁਹਾਨੂੰ ਬਿੱਲ ਦੇਵਾਂਗੇ ਜੀ ਐਸ ਟੀ ਵਾਲਾ ਕੱਟ ਕੇ ਹਾਂ ਠੱਗੀ ਵਾਲਾ ਕੰਮ ਨਹੀਂ ਹੋਊਗਾ ਵਧੀਆ ਤੁਹਾਡਾ ਮਾਣ ਤਾਣ ਵੀ ਰੱਖਾਂਗੇ ਬਿੱਲ ਵੀ ਦੇਵਾਂਗੇ ਗਾਰੰਟੀ ਵੀ ਦੇਵਾਂਗੇ ਤੁਹਾਨੂੰ ਹਾਂ ਕੋਈ ਰਿਪੇਅਰ ਕਰਵਾਉਣ ਵਾਲੀ ਰਿਪੇਅਰ ਵੀ ਕਰਵਾ ਕੇ ਦੇਵਾਂਗੇ

ਅਡਰੈਸ ਨਾ ਸਦਰ ਬਜ਼ਾਰ ਦੇ ਵਿੱਚ ਆ ਜੀ ਬਰਨਾਲਾ ਆਪਣੀ ਸ਼ੌਪ ਹਾਂਜੀ ਹਾਂਜੀ ਹਾਂਜੀ ਹਾਂਜੀ ਜਦੋਂ ਸਦਰ ਬਜ਼ਾਰ 'ਚ ਐਂਟਰ ਕਰੋਗੇ ਤਾਂ ਤੁਹਾਨੂੰ ਉੱਥੇ ਹੀ ਲੱਭ ਜਾਣੀ ਹੈ ਜੀ ਹਾਂਜੀ ਹਾਂਜੀ ਹਾਂ ਹਾਂ ਹਾਂ ਅਤੇ ਹਾਂ ਹਾਂ ਜ਼ਰੂਰ ਵਿਜਿਟ ਕਰਿਉ ਬਾਈ ਜੀ ਅਤੇ ਹਾਂਜੀ ਬਾਕੀ ਤੁਹਾਨੂੰ ਕੋਈ ਅਸੀਂ ਆਹ ਗਿਫਟ ਵੀ ਦਿੰਦਾ ਦੇਵਾਂਗੇ ਜੇ ਕੱਲ੍ਹ ਨੂੰ ਦਸ ਹਜ਼ਾਰ ਦੀ ਸ਼ੌਪਿੰਗ ਕਰਦੇ ਹੋ ਮਤ ਗਿਫਟ ਵੀ ਦਿੰਦੇ ਐਗੇ ਨਾਲ ਅਤੇ ਹਾਂਜੀ ਹਾਂਜੀ ਗਿਫਟ ਦਿੰਦੇ ਹਾਂ ਜੀ ਹਾਂਜੀ ਹਾਂਜੀ ਜ਼ਰੂਰ ਬਾਈ ਜੀ ਮੋਸਟ ਵੈਲਕਮ

ਓਕੇ ਜੀ ਓਕੇ ਫੇਰ